ਆਮ ਤੌਰ 'ਤੇ ਦੁਪਹਿਰ ਵੇਲੇ ਅਸੀਂ ਜਿਵੇਂ ਕੋਈ ਮਿੱਠੀ ਚੀਜ਼ ਖੀਰ ਕੜਾਹ ਜਾਂ ਮਿੱਠੇ ਚੌਲ ਵੀ ਬਣਾ ਲੈਂਦੇ ਹਾਂ ਅਤੇ ਕਈ ਵਾਰ ਘਰ ਵਿੱਚ ਮੀਟ ਆਂਡਾ ਵੀ ਬਣਦਾ ਹੈ ਅਤੇ ਕੜੀ ਚਾਵਲ ਦਾਲ ਚਾਵਲ ਹਰੀ ਸਬਜ਼ੀਆਂ ਦਹੀਂ ਭੱਲੇ ਦਹੀਂ ਪਕੌੜੀਆਂ ਵੀ ਦੁਪਹਿਰ ਵੇਲੇ ਬਣਦੀਆਂ ਹਨ ਕਿਉਂਕਿ ਇਹ ਦੁਪਹਿਰ ਵਾਲੇ ਕੰਮ ਕਾਰ ਕਰਦੇ ਇਹ ਸਾਰਾ ਕੁਝ ਜਲਦੀ ਹਜ਼ਮ ਹੋ ਜਾਂਦਾ ਹੈ ਅਤੇ ਰਾਤ ਦੇ ਖਾਣੇ ਵਿੱਚ ਅਸੀਂ ਜ਼ਿਆਦਾਤਰ ਹਰੀਆਂ ਸਬਜ਼ੀਆਂ ਹੀ ਪਕਾਉਂਦੇ ਹਾਂ ਜਿਵੇਂ ਗੋਭੀ ਗਾਜਰਾਂ ਕੱਦੂ ਭਿੰਡੀ ਤੋਰੀ ਸਲਾਦ ਦਾਲ ਦੇ ਦਾਲ ਨਾਲ ਦਾਲ ਚਾਵਲ ਵੀ ਬਣਦੇ ਹਨ ਇਹ ਇਹ ਸਾਨੂੰ ਬਹੁਤ ਸਵਾਦ ਲੱਗਦੇ ਹਨ